ਕੀ ਤੁਸੀਂ ਟੀ ਵੀ ਸ਼ੋ ਸ਼ਾਰਕ ਟੈਂਕ ਤੋਂ ਜਾਣੂ ਹੋ ਇਹ ਕਾਰ ਹਾਂਜੀ ਹਾਂ ਮੈਂ ਮੈਂ ਬਥੇਰੀ ਬਾਰ ਦੇਖਦਾ ਜਦੋਂ ਵੀ ਮੈਨੂੰ ਫਰੀ ਟਾਈਮ ਮਿਲਦਾ ਜਾਂ ਮੈਂ ਫਰੀ ਹੁੰਦਾ ਤਾਂ ਮੈਂ ਸ਼ਾਰਕ ਟੈਂਕ ਬਥੇਰੀ ਬਾਰ ਦੇਖਾ ਜੇ ਇਸ ਤੋਂ ਇਲਾਵਾ ਟੀ ਵੀ 'ਤੇ ਤਾਂ ਆਉਂਦਾ ਹੀ ਆਉਂਦਾ ਪਰ ਤੁਹਾਨੂੰ ਪਤਾ ਯੂਟੀਊਬ 'ਤੇ ਜਿਹੜਾ ਪਲੈਟਫਾਰਮ ਇਹਨਾਂ ਦਾ ਆਈ ਥਿੰਕ ਸੈਟ ਕਰਕੇ ਇਹਨਾਂ ਦਾ ਜਿਹੜਾ ਚੈਨਲ ਹੈ ਉਸ 'ਤੇ ਪਾਉਂਦੇ ਨੇ ਇਹ ਸ਼ਾਰਕ ਟੈਂਕ ਉਸ 'ਤੇ ਜੋ ਸ਼ਾਰਟ ਜਿਹੜੇ ਕਲਿਪਸ ਹੁੰਦੇ ਨੇ ਉਹਨਾਂ ਵੀ ਮੈਂ ਕਾਫ਼ੀ ਵਾਰ ਦੇਖਿਆ ਹੈ ਮੈਨੂੰ ਬੜਾ ਵਧੀਆ ਲੱਗਦਾ ਕਾਫ਼ੀ ਕਾਫ਼ੀ ਨਏ ਆਈਡੀਆਸ ਬਿਜ਼ਨਸ ਦੇ ਰਿਲੇਟਿਡ ਕਾਫ਼ੀ ਈਨੋਵੇਟ ਇਨੋਵੇਟਿਵ ਆਈਡੀਆ ਸਿੱਖਣ ਨੂੰ ਮਿਲਦੇ ਹਨ ਜਿਵੇਂ ਕਿ ਪਤਾ ਹੀ ਹੈ ਕਿ ਸ਼ਾਰਕ ਟੈਂਕ ਦੇ ਵਿੱਚ ਚਾਰ ਪੰਜ ਜਿਹੜੇ ਜਾਜਿਜ ਨੇ ਜੋ ਜਿਹਨੂੰ ਆਪਾਂ ਕਹਿੰਦੇ ਨੇ ਇਨਵੈਸਟਰ ਨੇ ਯਾਨੀ ਕਿ ਅਮਨ ਗੁਪਤਾ ਹੋ ਗਿਆ ਅਮਨ ਗੁਪਤਾ ਬੋਟ ਦੇ ਐਕਸ ਬੋਟ ਦੇ ਜੋ ਈ ਹੈਡਫੋਨ ਦੀ ਕੰਪਨੀ ਉਹਨਾਂ ਦੇ ਮਾਲਕ ਹਨ ਇਸ ਤੋਂ ਇਲਾਵਾ ਨਮਿਤਾ ਬੰਸਲ ਹੋ ਗਈ ਮੈਡਮ ਨਮਿਤਾ ਬੰਸਲ ਮੈਮ ਦੇ ਜਿਹੜੀ ਫਾਰਮਾ ਕਿਓਰ ਕੰਪਨੀ ਜਿਹੜੀ ਮੈਡੀਕਲ ਦੀ ਜਿਹੜੀ ਦਵਾਈਆਂ ਬਣਾਉਂਦੀ ਆ ਠੀਕ ਹੈ ਜੀ ਉਹ ਕੰਪਨੀ ਆ ਇਸ ਤੋਂ ਇਲਾਵਾ ਏ ਪਿਯੂਸ਼ ਸਰ ਉਹ ਵੀ ਬੜੇ ਮੇਰੇ ਜੋ ਫੇਵਰੇਟ ਨੇ ਪਿਯੂਸ਼ ਸਰ ਨੇ ਪਿਯੂਸ਼ ਸਰ ਦੇ ਵਿੱਚ ਤੁਹਾਨਾਂ ਨੂੰ ਪਤਾ ਹੀ ਹੈ ਉਹਨਾਂ ਜਿਹੜੇ ਆਪਣੇ ਲੈਂਸਕਾਰਟ ਕੰਪਨੀ ਉਹਨਾਂ ਦੇ ਜੋ ਮਾਲਕ ਨੇ ਪਿਯੁਸ਼ ਜੀ ਨੇ ਅਤੇ ਚੌਥਾ ਪਹਿਲਾਂ ਹਾਂ ਜੋ ਫਸਟ ਜਿਹੜਾ ਸੀਜ਼ਨ ਆਇਆ ਸੀ ਉਹਦੇ ਵਿੱਚ ਅਸ਼ਨੀਰ ਗਰੋਵਰ ਵੀ ਸੀਗੇ ਉਹ ਉਹ ਮੈਨੂੰ ਬੜੇ ਵਧੀਆ ਲੱਗਦੇ ਸੀਗੇ ਤੇ ਹਾਲਾਂਕਿ ਅਗਲੇ ਸੈਸ਼ਨ ਦੇ ਵਿੱਚ ਉਹਨਾਂ ਨੂੰ ਅਗਲੇ ਸੀਜ਼ਨ ਦੇ ਵਿੱਚ ਤਾਂ ਉਹਨਾਂ ਨੂੰ ਕੱਢ ਦਿੱਤਾ ਗਿਆ ਸੀ ਬਟ ਉਹ ਵੀ ਠੀਕ ਸੀ ਉਹਨਾਂ ਨੇ ਭਾਰਤ ਪੇ ਦੀ ਜੋ ਇਨਵੈਂਸ਼ਨ ਸੀ ਉਹਨਾਂ ਨੇ ਕਰੀ ਸੀਗੀ ਠੀਕ ਹੈ ਜੀ ਅਤੇ ਦੋ ਕੁ ਹੋਰ ਜਜੀਸ ਨੇ ਮੈਨੂੰ ਉਹਨਾਂ ਦਾ ਨਾਮ ਯਾਦ ਨਹੀਂ ਆ ਰਿਹਾ ਇੱਕ ਹੋਰ ਮੈਮ ਨੇ ਜਿਹੜੇ ਕਿ ਜਿਨ੍ਹਾਂ ਦਾ ਕਿ ਸ਼ੂਗਰ ਜੋ ਸ਼ੂਗਰ ਮੇਕਅਪ ਹੈ ਉਹਨਾਂ ਦਾ ਸ਼ਾਇਦ ਬਿਜਨਸ ਹੈ ਉਹ ਵੀ ਬੜੇ ਵਧੀਆ ਉਹ ਵੀ ਆਈ ਆਈ ਸ਼ਾਇਦ ਆਈ ਐਮ ਤੋਂ ਪੜ੍ਹੇ ਲਿਖੇ ਨੇ ਕਾਫ਼ੀ ਹਾਈ ਸਾਰੇ ਜਜੀਸ ਜਿਹੜੇ ਵਧੀਆ ਪੜ੍ਹੇ ਲਿਖੇ ਹਾਈਲੀ ਐਜੂਕੇਡ ਨੇ ਅਤੇ ਜਿਹੜੇ ਜਿਹੜੀ ਇਨਵੈਸਟਮੈਂਟ ਰੇਜ ਕਰਨ ਆਉਂਦੇ ਨੇ ਉਹਨਾਂ ਕੋਲ ਜੋ ਬਥੇਰੇ ਜੋ ਆਉਂਦੇ ਨੇ ਬੰਦੇ ਬਹੁਤ ਇਨੋਵੇਟਿਵ ਆਈਡੀਆ ਲੈ ਕੇ ਆਉਂਦੇ ਨੇ ਆਪਣੇ ਮੈਂ ਬਹੁਤ ਕਈ ਆਈਡੀਆਸ ਇਹੋ ਜਿਹੇ ਦੇਖੇ ਜਿਨ੍ਹਾਂ ਤੋਂ ਮੈਂ ਖੁਦ ਇਮਪ੍ਰੇਸ ਹੋਇਆ ਸੀਗਾ ਜਿਵੇਂ ਕਿ ਇੱਕ ਜੁਗਾੜੂ ਜੁਗਾੜੂ ਸਮਥਿੰਗ ਕਰਕੇ ਇਕ ਨਾਮ ਸੀਗਾ ਮੁੰਡੇ ਦਾ ਉਹਨੇ ਐਗਰੀਕਲਚਰ ਦੀ ਫੀਡ ਫੀਲਡ ਦੇ ਵਿੱਚ ਇਕ ਆਈਡੀਆ ਲੈ ਕੇ ਕੀ ਜਿਵੇਂ ਕੀ ਆਪਾਂ ਸਪਰੇ ਕਰਦੇ ਹਾਂ ਖੇਤਾਂ ਦੇ ਵਿੱਚ ਹੱਥ ਨਾਲ ਇਸ ਦੇ ਨਾਲ ਕਿਆ ਹੁੰਦਾ ਕਿ ਬਿਮਾਰੀਆਂ ਲੱਗਦੀਆਂ ਨੇ ਉਹ ਹੀ ਹੱਥਾਂ ਨਾਲ ਅਸੀਂ ਖਾਣਾ ਖਾਂਦੇ ਹਾਂ ਉਸ ਤੋਂ ਉਸ ਨੂੰ ਉਸ ਤੋਂ ਬਚਣ ਉਸ ਨੇ ਇੱਕ ਮਸ਼ੀਨ ਔਜ਼ਾਰ ਬਣਾਈ ਸੀ ਇਹ ਜਿਹਾ ਮਸ਼ੀਨ ਬਣਾਈ ਸੀ ਜਿਸ ਦੇ ਵਿੱਚ ਤੁਹਾਨੂੰ ਹੱਥ ਲਗਾਉਣ ਦੀ ਕੋਈ ਲੋੜ ਨਹੀਂ ਸਿਰਫ਼ ਤੁਸੀਂ ਚਲਾਓ ਅਤੇ ਕੰਮ ਵੀ ਬੜਾ ਸੌਖਾ ਕਰਦੇ ਇੱਕ ਟਾਈਮ 'ਤੇ ਬੜਾ ਜਲਦੀ ਜਲਦੀ ਖੇਤ 'ਚ ਪੂਰੇ ਸਪਰੇ ਕਰ ਦਿੰਦੀ ਆ ਟਾਈਮ ਵੀ ਬਚਾਉਂਦੀ ਹੈ ਬਿਮਾਰੀਆਂ ਵੀ ਨਹੀਂ ਲੱਗਦੀਆਂ ਠੀਕ ਹੈ ਜੀ ਅਤੇ ਤੁਹਾਡੀ ਲੇਬਰ ਵੀ ਬਚਾਊਗੀ ਇਹ ਬੜਾ ਵਧੀਆ ਆਈਡੀਆ ਲੱਗਿਆ ਸੀ ਇਸ ਤੋਂ ਇਲਾਵਾ ਹੋਰ ਕਾਫ਼ੀ ਇਹੋ ਜਿਹੇ ਬਿਜਨਸ ਬਿਜਨਸਮੈਨ ਆਉਂਦੇ ਨੇ ਜਿਨ੍ਹਾਂ ਦੇ ਦੋ ਦੋ ਜਿਨ੍ਹਾਂ ਦੇ ਵੀਹ ਵੀਹ ਸਾਲ ਪੁਰਾਣੇ ਬੀਜਨਸ ਨੇ ਪਰ ਉਹ ਐਕਸ ਉਹ ਨਹੀਂ ਕਰ ਸਕੇ ਖੁਦ ਨੂੰ ਐਕਸਪਲੋਰ ਨਹੀਂ ਕਰ ਸਕੇ ਜਾਂ ਉਹਨਾਂ ਦੀ ਇੰਨੀ ਜ਼ਿਆਦਾ ਕੁਆਲਿਟੀ ਉਹਨਾਂ ਦੀ ਵਧੀਆ ਹੁੰਦੀ ਹੈ ਬਟ ਖੁ ਖੁਦ ਨੂੰ ਫਿਰ ਵੀ ਵਧਾ ਨਹੀਂ ਸਕੇ ਬਿਜਨਸ ਤਾਂ ਉਹ ਉਹ ਪਲੈਟਫਾਰਮ ਇਹੋ ਜਿਹਾ ਕਿ ਜਿਹੜਾ ਕਿ ਤੁਹਾਡੇ ਬਿਜ਼ਨਸ ਨੂੰ ਇੱਕ ਫੇਮ ਦੇ ਸਕਦਾ ਤਾਂ ਮੈਨੂੰ ਲੱਗਦਾ ਕਿ ਵਧੀਆ ਇੱਕ ਪਲੈਟਫਾਰਮ ਹੈ ਅਤੇ ਬਹੁਤ ਅੱਛਾ ਲੱਗਦਾ ਮੈਂ ਦੇਖਣਾ ਇਸ ਤੋਂ ਇਲਾਵਾ ਇਹ ਕਾਰੋਬਾਰ ਸ਼ੁਰੂ ਕਰਨ ਲਈ ਲੋਕਾਂ ਨੂੰ ਕਿਵੇਂ ਪ੍ਰੇਰਿਤ ਕਰਨਾ ਹਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਹੀ ਹੈ ਕਿ ਲੋਕਾਂ ਨੂੰ ਪ੍ਰੇਰਿਤ ਕਰਦਾ ਜੀ ਕਿਉਂਕਿ ਜਿਵੇਂ ਤੁਸੀਂ ਦੇਖਿਆ ਕਿ ਮੈਨੇ ਲਾਸਟ ਟਾਈਮ ਦੇਖਿਆ ਇੱਕ ਕਾਰੋ ਇੱਕ ਸੀਗਾ ਬਿਜ਼ਨਸ ਜਿਹੜਾ ਕਿ ਉੱਥੇ ਆਇਆ ਸੀਗਾ ਉਸ ਟਾਈਮ ਇੰਨਾ ਜ਼ਿਆਦਾ ਫੇਮਸ ਨਹੀਂ ਸੀਗਾ ਬਟ ਜੇਦਾ ਜਿਹੜਾ ਕੋਈ ਇੱਕ ਵਾਰ ਉੱਥੇ ਆ ਜਾਣ ਉਸ ਪਲੈਟਫੋਰਮ ਆਉਂਦਾ ਤਾਂ ਹੁਣ ਮੇਰੇ ਮੈਂ ਇੱਕ ਆਮ ਨਾਗਰਿਕ ਹਾਂ ਹੁਣ ਮੈਨੂੰ ਕਿਆ ਹੋਵੇਗੀ ਮੈਨੂੰ ਕਰਿਉ ਕਰਿਓਸਿਟੀ ਹੋਵੇਗੀ ਕਿ ਅੱਛਾ ਹੈ ਕਿਆ ਆਖਿਰ ਮੈਂ ਦੇਖਣਾ ਚਾਹੂੰਗਾ ਕਿ ਇਹਦੇ ਵਿੱਚ ਹੈ ਕਿਆ ਇਸ ਬਿਜ਼ਨਸ ਦੇ ਵਿੱਚ ਕਿਆ ਚੀਜ਼ ਹੈ ਤਾਂ ਆਮ ਕਰਕੇ ਇਹ ਸਭ ਤੋਂ ਬੜੀ ਗੱਲ ਇਹ ਹੀ ਹੈ ਕਿ ਜਦੋਂ ਕੋਈ ਮੈਂ ਕਾਰੋ ਉੱਥੇ ਮੈਂ ਕਿਸੇ ਦਾ ਸ਼ੋ ਦੇਖਿਆ ਸਾਰਕ ਟੈਂਕ 'ਤੇ ਅਤੇ ਉੱਥੇ ਮੈਨੂੰ ਕੋਈ ਬੰਦਾ ਲੱਗਿਆ ਕਿ ਇਹ ਇਹਦੀ ਪ੍ਰੋਡਕਟ ਹੈ ਮੈਨੂੰ ਪਸੰਦ ਆ ਗਿਆ ਅਤੇ ਮੈਂ ਫਿਰ ਔਨਲਾਈਨ ਸਰਚ ਕੀਤਾ ਇਸ ਪ੍ਰੋਡਕਟ ਬਾਰੇ ਅਤੇ ਫਿਰ ਬੰਦੇ ਇਹ ਮੰਗਵਾਉਂਦੇ ਨੇ ਇਸ ਕਰਕੇ ਕਿ ਉਹਨਾਂ ਦੀ ਜਿਹੜੀ ਸੈਲਿੰਗ ਹੈ ਜਿਹੜਾ ਵੇਚਣ ਜਿਹੜਾ ਮਟੀਰੀਅਲ ਜ਼ਿਆਦਾ ਵਿਕਦਾ ਤਾਂ ਇਹ ਵੀ ਇੱਕ ਉਹਦਾ ਪਲਸ ਪੁਆਇੰਟ ਆ ਕਿ ਇੱਕ ਵਾਰ ਜਦੋਂ ਤੁਸੀਂ ਸ਼ਾਰਕ ਟੈਂਕ 'ਤੇ ਜਾਂਦੇ ਹੋ ਤਾਂ ਇਹੋ ਜਿਹੇ 'ਤੇ ਇਹੋ ਜਿਹੇ ਸ਼ੋ ਕਰਕੇ ਇਹੋ ਜਿਹੇ ਪਲੇਟਫਾਰਮ ਕਰਕੇ ਤੁਹਾਡਾ ਜਿਹੜਾ ਸੇਲ ਸੇਲਿੰਗ ਜਿਹੜੀ ਡਿਮਾਂਡ ਆ ਪ੍ਰੋਡਕਟ ਦੀ ਉਹ ਵੱਧਦੀ ਹੈ ਕਿਉਂਕਿ ਤੁਸੀਂ ਜ਼ਿਆਦਾ ਮਾਸ ਕਮਨੀਕੇਸ਼ਨ ਮਾਸ ਜਿਹੜੇ ਆਪਣੇ ਨੇ ਮਾਸ ਇੰਡਸਟਰੀ ਮਾਸ ਲੋਕਾਂ ਤੋਂ ਇਹ ਟਾਰਗੇਟ ਕਰ ਪਾਉਂਦੇ ਹੋ ਤਾਂ ਇਹ ਜ਼ਿਆਦਾ ਬੈਟਰ ਚੀਜ਼ ਹੈ ਤਾਂ ਠੀਕ ਹੈ ਮੈਨੂੰ ਠੀਕ ਲੱਗ ਲੱਗਿਆ ਇਹ ਸ਼ੋ ਵੀ ਮੈਨੂੰ ਬਹੁਤ ਪਿਆਰਾ ਲੱਗਦਾ ਹਾਲਾਂਕਿ ਮੇਰੇ ਪਰਿਵਾਰ ਦੇ ਮੇਰੇ ਡੈਡੀ ਮੇਰੇ ਮੰਮੀ ਮੇਰਾ ਏਵਨ ਮੇਰਾ ਭਰਾ ਵੱਡਾ ਭਰਾ ਉਹ ਵੀ ਅਸੀਂ ਸਾਰੇ ਬੈਠ ਕੇ ਦੇਖਦੇ ਹਾਂ ਕਾਫ਼ੀ ਵਧੀਆ ਵਧੀਆ ਇਨੋਵੇਟਿਵ ਆਈਡੀਆਜ਼ ਮਿਲਦੇ ਨੇ ਤਾਂ ਤਾਂ ਕਿ ਅਸੀਂ ਮੈਂ ਕਦੇ ਕੋਸ਼ਿਸ਼ ਕਰਦਾ ਕੇ ਮੈਂ ਵੀ ਕੋਈ ਇਹੋ ਜਿਹਾ ਆਈਡੀਆ ਬਣਾ ਕੇ ਅਤੇ ਮੈਂ ਵੀ ਸ਼ਾਰਕ ਟੈਂਕ ਵਰਗੇ 'ਚ ਜਾਵਾਂ ਇਨਵੇਸਟਮੇਂਟ ਰੇਜ ਕਰਾਂ ਬਟ ਹਜੇ ਜਿਵੇਂ ਖੁਦ ਹੀ ਮੈਂ ਤਿਆਰੀ ਕਰਦਾ ਇਸ ਲਈ ਮੈਂ ਹਜੇ ਇਹਨਾਂ ਕੰਮਾਂ ਦੇ ਵਿੱਚ ਆਪਣਾ ਜ਼ਿਆਦਾ ਧਿਆਨ ਨਹੀਂ ਦੇ ਪਾਉਂਦਾ ਪਰ ਸਟਿਲ ਕਿ ਇਹ ਹੀ ਹੈ ਕਿ ਚੀਜ਼ ਵਧੀਆ ਹੈ ਵਧੀਆ ਦੇਖਣ ਵਾਲਾ ਸ਼ੋ ਹੈ ਅਤੇ ਬਹੁਤ ਫ਼ਾਇਦੇਮੰਦ ਹੋ ਰਿਹਾ ਲੋਕਾਂ ਦੇ ਲਈ